ਹੈਲੋ ਵਧੀਆ ਗੱਗੂ ਤੁਸੀਂ ਦੱਸੋ ਹੋਰ ਅੱਛਾ ਕਿਵੇਂ ਅੱਛਾ ਮੈਂ ਤਾਂ ਅਰਦਾਸ ਦੀ ਅਡਮੀਸ਼ਨ ਇੱਥੇ ਮਾਲਵਾ ਸਕੂਲ 'ਚ ਕਰਵਾਈ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਹਾਂ ਹਾਂ ਹਾਂ ਹਾਂ ਜੀ ਜੀ ਐਸ ਕੋਲਜ ਦੇ ਨਾਲ ਮਾਲਵਾ ਸਕੂਲ ਕੋਲ ਹਾਂ ਹਾਂ ਉਹ ਵੀ ਉੱਥੇ ਹੀ ਆ ਗਿਆ ਆ ਤੁਸੀਂ ਸ਼ਾਹਿਦਾ ਨੂੰ ਲਗਾਉਣਾ ਅੱਛਾ ਠੀਕ ਹੈ ਨਾਲੇ ਵਧੀਆ ਸ਼ਾਹਿਦਾ ਅਤੇ ਉਹ ਇਕੱਠੇ ਚੱਲ ਜਾਇਆ ਕਰਨਗੇ ਆਪਾਂ ਕਰ ਲਾਂਗੇ ਗੱਲ ਕੋਈ ਗੱਲ ਨਹੀਂ ਹਾਂ ਬਾਕੀ ਫ਼ੀਸ ਦਾ ਪੁੱਛ ਲਿਆ ਤੁਸੀਂ ਕੁਛ ਗ ਹਾਂ ਅਤੇ ਬੱਚਿਆਂ ਲਈ ਕੀ ਮਤਲਬ ਕੁਛ ਫਸੀਲੀਟੀਜ਼ ਵਗੈਰਾ ਹੋਣ ਬਈ ਬੱਚੇ ਹੂੰ ਹੂੰ ਅੱਛਾ ਮਿਊਜ਼ਿਕ ਦਾ ਕੀ ਸਿਸਟਮ ਹੈ ਅਰਦਾਸ ਨੂੰ ਮਿਊਜ਼ਿਕ ਬਹੁਤ ਪਸੰਦ ਹੈ ਅੱਛਾ ਚਲੋ ਮੈਂ ਵੀ ਸੋਚਰੀ ਸੀ ਅਰਦਾਸ ਵੀ ਕਹਿ ਰਹੀ ਸੀ ਕਿ ਮੰਮਾ ਮੈਂ ਮਤਲਬ ਮਿਊਜ਼ਿਕ ਸਿੱਖਣਾ ਮੈਨੂੰ ਮਿਊਜ਼ਿਕ ਵਾਲੇ ਸਕੂਲ 'ਚ ਲਗਾਓ ਇੱਥੇ ਮਿਊਜ਼ਿਕ ਨਹੀਂ ਹੈ ਚਲੋ ਫਿਰ ਆਪਾਂ ਗੱਲ ਕਰਾਂਗੇ ਅਤੇ ਹੂੰ ਹਾਂ ਅੱਛਾ ਠੀਕ ਹੈ ਅਤੇ ਹੋਰ ਕੁਛ ਮਤਲਬ ਬੱਚਿਆਂ ਦੇ ਖਾਣ ਪੀਣ ਦਾ ਕੋਈ ਹੈ ਉੱਥੇ ਹਾਂ ਹੂੰ ਹੂੰ ਹਾਂ ਦਸ਼ਮੇਸ਼ ਵਧੀਆ ਆ ਮੈਂ ਵੀ ਦਸ਼ਮੇਸ਼ ਪਹਿਲਾਂ ਮੈਂ ਵੀ ਦੇਖਿਆ ਸੀ ਦਸ਼ਮੇਸ਼ ਚਲੋ ਕਰਦੇ ਹਾਂ ਆਪਾਂ ਗੱਲ ਫਿਰ ਠੀਕ ਹੈ ਓਕੇ